ਹੱਥ ਨਾਲ ਬੁਣੇ ਕੱਪੜੇ ਬਜ਼ਾਰ ਵਿੱਚ ਮਿਲਦੇ ਰੈਡੀਮੇਡ ਕੱਪੜਿਆਂ ਤੋਂ ਕਾਫੀ ਵਧੀਆ ਹੁੰਦੇ ਹਨ ਕਿਉਂਕਿ ਇਹ ਜ਼ਿਆਦਾ ਦੇਰ ਹੰਢਾਏ ਜਾ ਸਕਦੇ ਹਨ ਅਤੇ ਇਹ ਸਾਨੂੰ ਸਸਤੇ ਵੀ ਪੈਂਦੇ ਹਨ ਜਿਵੇਂ ਬਜ਼ਾਰ ਵਿੱਚ ਮਿਲਦੇ ਰੈਡੀਮੇਡ ਕੱਪੜੇ ਦਾ ਬਹੁਤ ਹੀ ਅੰਤਰ ਹੁੰਦਾ ਹੈ ਕੁਝ ਘਟੀਆ ਕੁਆਲਿਟੀ ਦਾ ਅਤੇ ਕੁਝ ਵਧੀਆ ਕੁਆਲਿਟੀ ਦਾ ਹੁੰਦਾ ਹੈ ਬਲਕਿ ਹੱਥ ਨਾਲ ਬੁਣੇ ਕੱਪੜੇ ਹਮੇਸ਼ਾਂ ਵਧੀਆ ਹੀ ਹੁੰਦੇ ਹਨ ਅਤੇ ਲੋਕ ਹੱਥ ਨਾਲ ਬੁਣੇ ਕੱਪੜੇ ਖਰੀਦਣਾ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇੱਕ ਤਾਂ ਇਹ ਸਸਤੇ ਪੈਂਦੇ ਹਨ ਦੂਸਰੇ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਅਤੇ ਇਹ ਜ਼ਿਆਦਾ ਟਾਈਮ ਲੰਘਾਉਂਦੇ ਹਨ ਹੱਥ ਦੇ ਬੁਣੇ ਕੱਪੜੇ ਬਜ਼ਾਰ ਵਿੱਚ ਮਿਲਦੇ ਰੈਡੀਮੇਡ ਕੱਪੜਿਆਂ ਤੋਂ ਕਾਫੀ ਬਿਹਤਰ ਹੁੰਦੇ ਹਨ ਬਜ਼ਾਰ ਵਿੱਚ ਮਿਲਦੇ ਰੈਡੀਮੇਡ ਕੱਪੜੇ ਬਹੁਤ ਮਹਿੰਗੇ ਹੁੰਦੇ ਹਨ ਜੇ ਦੇਖਿਆ ਜਾਏ ਤਾਂ ਹੱਥ ਨਾਲ ਬੁਣੇ ਕੱਪੜਿਆਂ ਤੋਂ ਮਹਿੰਗੇ ਰੈਡੀਮੇਡ ਕੱਪੜੇ ਹੁੰਦੇ ਹਨ ਅਤੇ ਉਹਨਾਂ ਦੀ ਏਜ ਲਾਈਫ ਵੀ ਬਹੁਤ ਹੀ ਘੱਟ ਹੁੰਦੀ ਹੈ ਬਹੁਤ ਹੀ ਘੱਟ ਟਾਈਮ ਹੰਢਾਏ ਜਾਂਦੇ ਹਨ ਬਲਕਿ ਹੱਥ ਨਾਲ ਬੁਣੇ ਕੱਪੜੇ ਜ਼ਿਆਦਾ ਟਾਈਮ ਹੰਢਾਏ ਜਾ ਸਕਦੇ ਹਨ ਧੰਨਵਾਦ